ਹੈਲੋ ਹਾਂਜੀ ਸਰ ਸਮਾਟ ਫੋਟੋਗਰਾਫਰ ਬਰਨਾਲਾ ਸਰ ਸਰ ਮੈਂ ਪ੍ਰੀ ਵੈਡਿੰਗ ਦੇ ਰਿਲੇਟਡ ਗੱਲ ਕਰਨੀ ਸੀਗੀ ਆਪਣਾ ਸਰ ਮਤਲਵ ਕੀ ਪਰਾਈਜ਼ ਹੁੰਦਾ ਅਤੇ ਕੀ ਸਿਸਟਮ ਹੁੰਦਾ

ਪੰਜਾਬ 'ਚ ਕਰਵਾਉਣੀ ਹੋਵੇ ਫਿਰ ਸਰ ਹਾਂਜੀ ਸਰ ਹਾਂਜੀ ਸਰ ਨਵੰਬਰ 'ਚ ਵਿਆਹ ਹੀ ਹੁੰਦੇ ਸਰ ਆਪਣੇ ਮਤਲਬ ਬਰਨਾਲਾ ਸੰਗਰੂਰ ਏਰੀਆ 'ਚ ਵੀ ਹੁੰਦੇ ਮਤਲਬ ਅਲੱਗ ਉਧਰਲੇ ਪਾਸੇ ਨੇ ਆਪਣੇ ਬਰਨਾਲੇ 'ਚ ਵੀ ਹੁੰਦੀ ਹੈ ਕਿ ਮਤਲਬ ਹੋਰ ਸੰਗਰੂਰ ਏਰੀਏ 'ਚ ਹਾਂਜੀ ਸਰ ਇਧਰ ਤਾਂ ਹਾਂਜੀ ਸਰ ਠੀਕ ਹੈ ਸਰ ਮੈਂ ਸਰ ਦੇਖੀ ਸੀ ਨਾ ਆਪਣੇ ਸਮਾਰਟ ਫੋਟੋਗਰਾਫਰ ਬਰਨਾਲਾ ਦੀ ਇੱਕ ਪ੍ਰੀ ਵੈਡਿੰਗ ਸਰ ਅਤੇ ਮੈਨੂੰ ਅਤੇ ਮੈਨੂੰ ਵਧੀਆ ਲੱਗੀ ਅਤੇ ਮੈਂ ਤਾਂਹੀ ਇਸ ਰਿਗਾਰਡਿੰਗ ਕੀਤਾ ਸੀ ਅਤੇ ਸਰ ਇਹਦੇ ਵਿੱਚ ਇਹਦੇ ਵਿੱਚ ਕੋਈ ਰੇਟ ਮਤਲਬ ਫਿਕਸ ਹੁੰਦਾ ਜਾਂ ਮਤਲਬ ਵੱਧ ਘੱਟ ਹੋ ਜਾਂਦਾ

ਹਾਂ ਸਰ ਹਾਂਜੀ ਸਰ ਹਾਂਜੀ ਸਰ ਠੀਕ ਹੈ ਸਰ ਓਕੇ ਸਰ